ਹੈਲੋ ਸਤਿ ਸ਼੍ਰੀ ਅਕਾਲ ਜੀ ਏਅਰ ਇੰਡੀਆ ਤੋਂ ਬੋਲਦੇ ਪਏ ਆ ਜੀ ਹਾਂਜੀ ਹਾਂਜੀ ਮੈਮ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਜੀ ਤੁਸੀਂ ਦੱਸ ਸਕਦੇ ਹੋ ਕਿੰਨੀ ਤਾਰੀਕ ਨੂੰ ਤੁਸੀਂ ਟਿਕਟ ਕਰਵਾਈ ਸੀ ਜੀ ਓਕੇ ਜੀ ਟਿਕਟ ਦਾ ਨੰਬਰ ਜੀ ਓਕੇ ਜੀ ਅਸੀਂ ਤੁਹਾਨੂੰ ਦੱਸਣਾ ਚਾਹਵਾਂਗੇ ਜੀ ਜਿਵੇਂ ਕਿ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਅਸੀਂ ਤੁਹਾਡੀ ਟਿਕਟ ਜਿਹੜੀ ਹੈਗੀ ਆ ਉਹ ਕੈਂਸਲ ਤਾਂ ਹੋ ਜਾਵੇਗੀ ਜੀ ਬਟ ਰੀਫੰਡ ਤੁਹਾਨੂੰ ਫਿਰ ਉਹ ਪੰਜਾਹ ਪਰਸੈਂਟ ਹੀ ਮਿਲ ਪਾਵੇਗਾ ਅਤੇ ਇਸ ਤੋਂ ਇਲਾਵਾ ਸਾਡੇ ਕੋਲ ਦੋ ਤਿੰਨ ਹੋਰ ਚੀਜ਼ਾਂ ਨੇ ਅਸੀਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਿੰਦੇ ਹਾਂ ਕਿ ਜੇ ਤੁਸੀਂ ਇਸ ਟਿਕਟ ਨੂੰ ਅੱਗੇ ਕਰਵਾਉਣਾ ਚਾਹੋਗੇ ਤਾਂ ਉਸ ਦਿਨ ਦਾ ਅਸੀਂ ਵੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੀ ਟਿਕਟ ਕੀ ਅੱਗੇ ਹੋ ਸਕਦੀ ਹੈ ਨਹੀਂ ਤਾਂ ਜੇ ਤੁਸੀਂ ਕੈਂਸਲ ਕਰਵਾਓਗੇ ਤਾਂ ਤੁਹਾਨੂੰ ਪੰਜਾਹ ਪਰਸੈਂਟ ਰੀਫੰਡ ਮਿਲੇਗਾ ਅਤੇ ਉਹ ਤੁਹਾਡੇ ਅਕਾਊਂਟ ਦੇ ਵਿੱਚ ਬਹੱਤਰ ਤੋਂ ਚੁਰਾਸੀ ਘੰਟਿਆਂ ਦੇ ਵਿੱਚ ਵਾਪਸ ਦੇ ਦਿੱਤਾ ਜਾਊਗਾ ਬਹੱਤਰ ਤੋਂ ਚੁਰਾਸੀ ਘੰਟਿਆਂ ਦੇ ਵਿੱਚ ਤੁਹਾਡੇ ਪੈਸੇ ਤੁਹਾਡੇ ਖਾਤੇ ਵਿੱਚ ਆ ਜਾਣਗੇ ਅਤੇ ਜਿਹੜੇ ਪੋਰਟਲ ਤੋਂ ਤੁਸੀਂ ਪੈਸੇ ਪੇ ਕੀਤੇ ਸੀ ਉਹ ਉਹਦੇ ਦੁਆਰਾ ਹੀ ਤੁਹਾਡੇ ਖਾਤੇ ਵਿੱਚ ਆਉਣਗੇ ਅਤੇ ਜਿਹੜਾ ਖਾਤਾ ਦਿੱਤਾ ਹੋਇਆ ਤੁਸੀਂ ਯਾਨੀ ਕਿ ਜਿੱਥੋਂ ਕਰਾਈ ਬੁੱਕ ਉਧਰੋਂ ਹੀ ਤੁਹਾਡਾ ਰੀਫੰਡ ਮਿਲੂ ਉਹ ਤੁਹਾਨੂੰ ਅਸੀਂ ਤੁਸੀਂ ਦੱਸ ਦਿਓ ਤੁਹਾਨੂੰ ਕਿਹੜੇ ਯਾਨੀ ਕਿ ਅਗਲੇ ਦਿਨ ਕਿੰਨੇ ਦਿਨਾਂ ਦੇ ਵਿੱਚ ਚਾਹੀਦੀ ਹੈ ਉਹ ਅਸੀਂ ਉਸ ਮੁਤਾਬਿਕ ਤੁਹਾਨੂੰ ਦੱਸ ਸਕਦੇ ਹਾਂ ਨਹੀਂ ਨਹੀਂ ਅਸੀਂ ਡੈਸਟੀਨੇਸ਼ਨ ਦੇ ਬਾਰੇ ਪੋਰਟਲ ਨਹੀਂ ਅਸੀਂ ਚੇਂਜ ਕਰ ਸਕਦਾ ਸ਼ੋ ਨਹੀਂ ਕਰਦਾ ਜੀ ਤੁਸੀਂ ਤਾਰੀਕ ਵੇਖ ਲਓ ਉਹਦੇ ਮੁਤਾਬਿਕ ਦੱਸ ਸਕਦੇ ਹਾਂ ਹੁਣ ਜਿਵੇਂ ਤੁਸੀਂ ਜਿਵੇਂ ਤੁਸੀਂ ਦੱਸਿਆ ਸੀ ਸੱਤ ਨੂੰ ਜਾਣਾ ਹੈ ਨੌਂ ਨੂੰ ਸੀਟਸ ਅਵੇਲੇਬਲ ਹੈਗੀਆਂ ਨੇ ਜੀ ਦਸ ਨੂੰ ਹੈ ਗਿਆਰ੍ਹਾਂ ਨੂੰ ਵੀ ਹੈ ਬਾਰ੍ਹਾਂ ਨੂੰ ਨਹੀਂ ਹੈਗੀ ਜੀ ਤੇਰ੍ਹਾਂ ਨੂੰ ਹੈ ਅਤੇ ਸੇਮ ਡੇ ਨੂੰ ਵੀ ਤੁਹਾਨੂੰ ਚਾਹੀਦੀ ਹੈ ਅਗਰ ਰਾਤ ਦੀ ਤਾਂ ਰਾਤ ਦੀ ਵੀ ਫਲਾਈਟ ਦੇ ਵਿੱਚ ਟਿਕਟ ਅਵੇਲੇਬਲ ਹੈ ਅਤੇ ਐਕਸਟਰਾ ਚਾਰਜਿਸ ਤੁਹਾਡੇ ਨਹੀਂ ਲੱਗਣਗੇ ਤੁਹਾਨੂੰ ਸੇਮ ਉਸੇ ਵਿੱਚ ਹੀ ਅਸੀਂ ਤੁਹਾਡੀ ਟਿਕਟ ਅੱਗੇ ਕਰ ਦੇਵਾਂਗੇ ਜੀ ਓਕੇ